ਚੌਦਾਂ ਫਰਵਰੀ ਦੋ ਹਜ਼ਾਰ ਤੇਈ ਪੱਚੀ ਮਈ ਦੋ ਹਜ਼ਾਰ ਤੇਈ ਸਤਾਈ ਜੁਲਾਈ ਦੋ ਹਜ਼ਾਰ ਤੇਈ ਦੋ ਅਕਤੂਬਰ ਦੋ ਹਜ਼ਾਰ ਤੇਈ ਸਤਾਈ ਦਸੰਬਰ ਦੋ ਹਜ਼ਾਰ ਤੇਈ